ਆਪਣੇ ਰੋਜ਼ਾਨਾ ਦੇ ਕੰਮ ਬਾਰੇ ਦੱਸੋ ਮੈਂ ਸਵੇਰੇ ਛੇ ਵਜ਼ੇ ਉੱਠ ਜਾਂਦੀ ਹਾਂ ਉਸ ਤੋਂ ਬਾਅਦ ਮੈਂ ਬਰੱਸ਼ ਕਰਦੀ ਹਾਂ ਉਸ ਤੋਂ ਬਾਅਦ ਫਿਰ ਮੈਂ ਨਹਾਉਣਾਂ ਫਿਰ ਚਾਹ ਕੱਪ ਪੀਣੀ ਫਿਰ ਮੈਂ ਬਾਹਰ ਸੈਰ ਕਰਨ ਚਲੇ ਜਾਣਾ ਅਤੇ ਉਸ ਤੋਂ ਬਾਅਦ ਸੈਰ ਕਰਕੇ ਆ ਕੇ ਨਾਸ਼ਤੇ ਦੀ ਤਿਆਰੀ ਨਾਸ਼ਤੇ ਤੋਂ ਬਾਅਦ ਅਸੀਂ ਫਿਰ ਦਸ ਗਿਆਰਾਂ ਵਜ਼ੇ ਖਬਰਾਂ ਸੁਣਨੀਆਂ ਬੈਠ ਕੇ ਟੀ ਵੀ ਦੇਖਣਾ ਥੋੜ੍ਹਾ ਬਹੁਤ ਉਸ ਤੋਂ ਬਾਅਦ ਅਸੀਂ ਥੋੜ੍ਹਾ ਸਿਲਾਈ ਬੁਣਾਈ ਵੱਲ ਧਿਆਨ ਦਿੰਦੇ ਹਾਂ ਫਿਰ ਮੇਰੀ ਫ੍ਰੇਂਡ ਆ ਜਾਂਦੀ ਹੈ ਫਿਰ ਅਸੀਂ ਬੈਠ ਜਾਂਦੀ ਐਂ ਬੁਣਨ ਵਾਸਤੇ ਸਿਲਾਈ ਬੁਣ ਬੁਣਨ ਵਾਸਤੇ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਹੋ ਜਾਂਦਾ ਹੈ ਫਿਰ ਸਾਡੀ ਸ਼ੋਪ ਹੈ ਸ਼ੋਪ 'ਤੇ ਰੋਟੀ ਦੇਣੀ ਹੁੰਦੀ ਹੈ ਫਟਾਫਟ ਉਹਨਾਂ ਦਾ ਪੈਕ ਕੀਤਾ ਖਾਣਾ ਭੇਜਿਆ ਅਤੇ ਉਸ ਤੋਂ ਬਾਅਦ ਫਿਰ ਅਸੀਂ ਥੋੜ੍ਹੀ ਦੇਰ ਆਰਾਮ ਕਰਨਾ ਹੈ ਫਿਰ ਅਸੀਂ ਉੱਠ ਕੇ ਚਾਰ ਵਜ਼ੇ ਚਾਹ ਦਾ ਕੱਪ ਤਿਆਰ ਕਰਕੇ ਚਾਹ ਪੀਕੇ ਫਿਰ ਬਾਹਰ ਸੈਰ ਨੂੰ ਚਲੇ ਜਾਣਾ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਅਸੀਂ ਰਾਤ ਦਾ ਖਾਣਾ ਤਿਆਰ ਕਰਨ ਲੱਗ ਜਾਣਾ ਹਾਊਸਵਾਈਫ਼ ਦਾ ਕੰਮ ਇਹ ਹੀ ਹੈ ਵੀ ਘਰ ਦੇ ਵਿੱਚ ਘਰ ਦਾ ਖਾਣਾ ਔਰ ਕੱਪੜੇ ਸਫ਼ਾਈ ਔਰ ਤੋਂ ਠੀਕ